ਖੇਤਰੀ ਪੰਜਾਬੀ ਸਾਹਿਤ ਅਤੇ ਰਾਸ਼ਟਰੀ ਭਾਰਤੀ ਸਾਹਿਤ ਦੇ ਆਪਸੀ ਤਾਲਮੇਲ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ ਜਿਵੇਂ ਕਿ ਆਪਾਂ ਲੈ ਲਈਏ ਭਾਸ਼ਾਵਾਂ ਪੰਜਾਬੀ ਭਾਸ਼ਾ ਅਤੇ ਹਿੰਦੀ ਭਾਸ਼ਾਵਾਂ ਬਹੁਤ ਹੀ ਬਹੁਤ ਹੀ ਸੇਮ ਭਾਸ਼ਾ ਹੈ ਬਹੁਤ ਹੀ ਮੇਲਦਾਰ ਭਾਸ਼ਾ ਹੈ ਜਿਵੇਂ ਕਿ ਪੰਜਾਬੀ ਦੇ ਕਈ ਸ਼ਬਦ ਹਨ ਜੋ ਹਿੰਦੀ ਤੋਂ ਲਏਗਾ ਲਏ ਗਏ ਹਨ ਅਤੇ ਕਈ ਸ਼ਬਦ ਜੋ ਹੈ ਉਹ ਸੰਸਕ੍ਰਿਤ ਤੋਂ ਲਿੱਤੇ ਗਏ ਹਨ ਅਤੇ ਹਿੰਦੀ ਭਾਸ਼ਾ ਤਾਂ ਲਈ ਹੀ ਸੰਸਕ੍ਰਿਤ ਤੋਂ ਲਈ ਗਈ ਹੈ ਜਿਵੇਂ ਮਾਤਾ ਪਿਤਾ ਦੋਨਾਂ ਭਾਸ਼ਾਵਾਂ ਵਿੱਚ ਸੇਮ ਹੀ ਹਨ ਹੋਰ ਵੀ ਕਈ ਇਸ ਤਰ੍ਹਾਂ ਦੇ ਸ਼ਬਦ ਹਨ ਜਿਹੜੇ ਕਿ ਇਹ ਦੋਨੇ ਭਾਸ਼ਾਵਾਂ ਵਿੱਚ ਸੇਮ ਹੁੰਦੇ ਹਨ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਪ੍ਰਭਾਵਿਤ ਇਸ ਤਰ੍ਹਾਂ ਕਰਦੇ ਹਨ ਜਿਵੇਂ ਕਿ ਜੋ ਇਨਸਾਨ ਜਾਂ ਫਿਰ ਜੋ ਪੰਜਾਬ ਦਾ ਰਹਿਣ ਵਾਲਾ ਹੈ ਉਹ ਹਿੰਦੀ ਭਾਸ਼ਾ ਬਹੁਤ ਆਸਾਨੀ ਨਾਲ ਸਮਝ ਸਕਦਾ ਹੈ ਜੇ ਆਪਾਂ ਕੰਪੈਰੀਜਨ ਕਰੀਏ ਬਾਕੀ ਭਾਸ਼ਾਵਾਂ ਦੇ ਨਾਲ ਜਿਵੇਂ ਕਿ ਅਗਰ ਕੋਈ ਸਾਊਥ ਇੰਡੀਆ ਦਾ ਬੰਦਾ ਹੈ ਤਾਂ ਉਹਨੂੰ ਹਿੰਦੀ ਸਮਝ ਨਹੀਂ ਆਉਂਦੀ ਜਦੋਂ ਤੱਕ ਉਹ ਪੜ੍ਹਿਆ ਜਾਂ ਲਿਖਿਆ ਨਹੀਂ ਹੋਵੇਗਾ ਹਿੰਦੀ ਭਾਸ਼ਾ ਦੇ ਵਿੱਚ ਉਹ ਹੀ ਜੇ ਆਪਾਂ ਇੱਕ ਪੰਜਾਬੀ ਵੇਖੀਏ ਚਾਹੇ ਜਿਸਨੂੰ ਹਿੰਦੀ ਬੋ ਜਿਸਨੂੰ ਹਿੰਦੀ ਲ ਪੜ੍ਹਨੀ ਨਾ ਆਉਂਦੀ ਹੋਵੇ ਜਾਂ ਫਿਰ ਬੋਲਣੀ ਨਾ ਆਉਂਦੀ ਹੋਵੇ ਪਰ ਉਹ ਹਿੰਦੀ ਸ ਸਮਝ ਜ਼ਰੂਰ ਲਏਗਾ ਇਸ ਤਰ੍ਹਾਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਸ ਦੇ ਨਾਲ ਹੀ ਜਿਵੇਂ ਹੁਣ ਆਪਾਂ ਭਾਰਤੀ ਭਾਰਤੀ ਸਾਹਿਤ ਵੇਖ ਲਈਏ ਭਾਰਤੀ ਸਾਹਿਤ ਵਿੱਚ ਕੀ ਹੈ ਉਹ ਆਪ ਉਹ ਹੁੰਦਾ ਹੈ ਹੀ ਇੱਕ ਮੇਲ ਭਾਰਤੀ ਸਾਹਿਤ ਵਿੱਚ ਪੰਜਾਬੀ ਸਾਹਿਤ ਹੈ ਹਿੰਦੀ ਸਾਹਿਤ ਹੈ ਫਿਰ ਅਤੇ ਸਾਊਥ ਇੰਡੀਆ ਵਿੱਚ ਵੇਖੀਏ ਤਾਂ ਤਾਮਿਲ ਸਾਹਿਤ ਤੇਲਗੂ ਤਾਮਿਲ ਕਿੰਨੀਆਂ ਭਾਸ਼ਾਵਾਂ ਕੰਨੜ ਭਾਸ਼ਾ ਹੈਗੀ ਆ ਉੜੀਸਾ ਭਾਸ਼ਾ ਬੰਗਾਲੀ ਭਾਸ਼ਾ ਅਸਾਮੀ ਭਾਸ਼ਾ ਕਿੰਨੀਆਂ ਹੀ ਭਾਸ਼ਾਵਾਂ ਹਨ ਆਪਣੇ ਦੇਸ਼ ਵਿੱਚ ਉਣੱਤੀ ਰਾਜ ਹਨ ਉਣੱਤੀ ਰਾਜਾਂ ਦੀਆਂ ਹਰ ਇੱਕ ਰੀਜਨ ਦੀ ਹਰ ਅੱਡ ਅੱਡ ਭਾਸ਼ਾ ਹੈ ਡੋਗਰੀ ਭਾਸ਼ਾ ਹੋ ਗਈ ਜਿਵੇਂ ਜੰਮੂ ਕਸ਼ਮੀਰ ਦੀ ਹਿਮਾਚਲੀ ਭਾਸ਼ਾ ਹੋ ਗਈ ਹਿਮਾਚਲ ਵਿੱਚ ਵੀ ਕਿੰਨੇ ਤਰ੍ਹਾਂ ਦੇ ਮੰਡੀ ਹੋ ਗਈ ਫੇ ਮੰਡਿਆਲੀ ਹੋ ਗਈ ਜਾਂ ਫਿਰ ਕਿੰਨੀ ਤਰ੍ਹਾਂ ਦੀ ਜਾਂ ਫਿਰ ਪੰਜਾਬ ਵਿੱਚ ਵੇਖੀਏ ਤਾਂ ਮਾਝਾ ਮਾਲ ਮਾਝੀ ਭਾਸ਼ਾ ਹੋ ਗਈ ਮਾਲਵਈ ਭਾਸ਼ਾ ਹੋ ਗਈ ਇਹ ਵੀ ਇਹ ਸਾਰੀਆਂ ਮਿਲ ਕੇ ਹੀ ਪੰਜਾਬੀ ਸਾਹਿਤ ਬਣਾਉਂਦੀਆਂ ਹਨ ਉਸ ਤਰ੍ਹਾਂ ਹੀ ਭਾਰਤ ਦਾ ਜਿਹੜਾ ਸਾਹਿਤ ਹੈ ਉਹ ਵੱਖ ਵੱਖ ਰੀਜਨਸ ਦੇ ਭਾਸ਼ਾਵਾਂ ਨੂੰ ਮਿਲ ਕੇ ਬਣਿਆ ਹੈ ਇਸ ਤਰ੍ਹਾਂ ਇੱਕ ਦੂਜੇ ਨਾਲ ਪ੍ਰਭਾਵਿਤ ਵੀ ਕਰਦੇ ਹਨ